ਅੱਜ ਕੱਲ੍ਹ ਸਿਹਤ ਵਿਭਾਗ ਬਹੁਤ ਹੀ ਮਹਿੰਗਾ ਹੁੰਦਾ ਜਾ ਰਿਹਾ ਹੈ ਔਰ ਉਸ ਦੇ ਖਰਚੇ ਦਿਨੋਂ ਦਿਨ ਵਧਦੇ ਜਾ ਰਹੇ ਹਨ ਤੁਸੀਂ ਕਿਸੇ ਵੀ ਡਾਕਟਰ ਕੋਲ ਜਾਂ ਕਿਸੇ ਵੀ ਮੈਡੀਕਲ ਸਟੋਰ 'ਤੇ ਜਾਂ ਇੱਕ ਦਵਾਈਆਂ ਵਾਲੀ ਦੁਕਾਨ 'ਤੇ ਚਲੇ ਜਾਓ ਤਾਂ ਇਤਨੀ ਮਹਿੰਗੀਆਂ ਦਵਾਈਆਂ ਮਿਲਦੀਆਂ ਹਨ ਕਿ ਆਮ ਆਦਮੀ ਦੇ ਪੋਕਿਟ ਤੋਂ ਉਹਦੇ ਉਹਦੇ ਹੱਥ ਤੋਂ ਉਹਦੀ ਪਹੁੰਚ ਤੋਂ ਬਾਹਰ ਹੈ ਅਤੇ ਇਸੇ ਤਰ੍ਹਾਂ ਡਾਕਟਰਾਂ ਦੀਆਂ ਵੀ ਫੀਸਾਂ ਇੰਨੀਆਂ ਵੱਧਦੀਆਂ ਜਾ ਰਹੀਆਂ ਹਨ ਕਿ ਉੱਥੇ ਵੀ ਕੋਈ ਆਮ ਆਦਮੀ ਜਾ ਨਹੀਂ ਸਕਦਾ ਉਹਦੇ ਕੋਲ ਵੀ ਜਾਣ ਲੱਗਿਆਂ ਉਹਨੂੰ ਪੰਜਾਹ ਵਾਰੀ ਸੋਚਣਾ ਪੈਂਦਾ ਹੈ ਇਸ ਨੂੰ ਇਸ ਸਮੱਸਿਆ ਨੂੰ ਹੱਲ ਕਰਨ ਲਈ ਹਰ ਜਗ੍ਹਾ ਰਾਜ ਸਰਕਾਰਾਂ ਨੇ ਆਪਣੇ ਆਪਣੇ ਉਪਰਾਲੇ ਕੀਤੇ ਹੋਏ ਹਨ ਕਿਉਂਕਿ ਮੈਂ ਪੰਜਾਬ ਦਾ ਰਹਿਣ ਵਾਲਾ ਹਾਂ ਅਤੇ ਇਸ ਲਈ ਇੱਥੇ ਆਮ ਆਦਮੀ ਪਾਰਟੀ ਨੇ ਮੁਹੱਲਾ ਕਲੀਨਿਕ ਖੋਲ੍ਹੇ ਗਏ ਹਨ ਜਿਹੜੇ ਕਿ ਬਿਲਕੁਲ ਹੀ ਫ੍ਰੀ ਹਨ ਜਿਹਦੇ ਵਿੱਚ ਵੀ ਇੱਕ ਵੀ ਤੁਹਾਨੂੰ ਪੈਸਾ ਨਹੀਂ ਦੇਣਾ ਪੈਂਦਾ ਅਤੇ ਇਸ ਉੱਥੋਂ ਦੀ ਦਵਾਈਆਂ ਵੀ ਉੱਥੋਂ ਹੀ ਮਿਲ ਜਾਂਦੀਆਂ ਹਨ ਇਸੇ ਤਰ੍ਹਾਂ ਨਾਲ਼ ਕਈ ਟਰੱਸਟ ਵੱਲੋਂ ਕਈ ਚੈਰਿਟੀ ਵੱਲੋਂ ਸੰਸਥਾਵਾਂ ਹਨ ਜਿਨ੍ਹਾਂ ਨੇ ਕਿ ਆਪਣੇ ਘੱਟ ਰੇਟਾਂ ਦੇ ਉੱਤੇ ਹੋਸਪਿਟਲ ਵੀ ਖੋਲ੍ਹੇ ਹਨ ਅਤੇ ਮੈਡੀਕਲ ਸਟੋਰ ਦਵਾਈਆਂ ਦੀਆਂ ਦੁਕਾਨਾਂ ਵੀ ਖੋਲ੍ਹੀਆਂ ਹਨ ਜਿੱਥੋਂ ਕਿ ਤੁਹਾਨੂੰ ਦਵਾਈਆਂ ਬਹੁਤ ਹੀ ਘੱਟ ਰੇਟ 'ਤੇ ਮਿਲ ਜਾਂਦੀਆਂ ਹਨ ਅਤੇ ਇਸ ਸਮੱਸਿਆ ਨੂੰ ਜੂਝਣ ਵਾਸਤੇ ਹੋਰ ਵੀ ਇਸੇ ਤਰ੍ਹਾਂ ਕਈ ਵਾਰੀ ਹਸਪਤਾਲਾਂ ਵਾਲੇ ਵੀ ਮੈਡੀਕਲ ਕੈਂਪ ਲਗਾਉਂਦੇ ਹਨ ਜਿ ਜਿੱਥੇ ਕਿ ਟ੍ਰੀਟਮੈਂਟ ਬਿਲਕੁਲ ਫ੍ਰੀ ਦੇ ਵਿੱਚ ਕੀਤਾ ਜਾਂਦਾ ਹੈ ਅਤੇ ਉੱਥੇ ਉ ਉੱਥੋਂ ਦਵਾਈਆਂ ਵੀ ਫ੍ਰੀ ਮਿਲਦੀਆਂ ਹਨ